ਕਿਵੇਂ ਹੈ ਨੈਨਸੀ ਬੋਲ ਦੀ ਹਾਂ ਵਧੀਆ ਆ ਤੂੰ ਦੱਸ ਬਸ ਕੁਝ ਨਹੀਂ ਪਲੱਸ ਟੂ ਕਰਕੇ ਹਟੀ ਹਾਂ ਅੱਛਾ ਯਾਰ ਤੂੰ ਮੈਨੂੰ ਦੱਸ ਸਕਦੀ ਆਪਣੇ ਪੰਜਾਬ ਵਿੱਚ ਕਿਹੜੀਆਂ ਕਿਹੜੀਆਂ ਯੂਨੀਵਰਸਿਟੀਆਂ ਏ

ਅੱਛਾ

ਅੱਛਾ ਅੱਛਾ ਯਾਰ ਮੈਂ ਨਾ ਕੰਨਫਿਊਜ਼ ਹਾਂ ਕਿ ਮੈਂ ਪੀ ਯੂ ਕਰਾਂ ਕਿ ਸੀ ਯੂ ਅੱਛਾ ਚੱਲ ਕੋਈ ਨਾ ਮੈਂ ਬੀ ਕੌਮ ਕਰਨੀ ਹੈ ਹਾਂ ਹੋਰ ਯਾਰ ਮੈਂ ਆਪਣੇ ਘਰਦਿਆਂ ਨੂੰ ਪੁੱਛ ਕੇ ਦੱਸੂਂਗੀ ਠੀਕ ਹੈ ਹਾਂ ਅੱਛਾ ਠੀਕ ਹੈ ਹਾਂਜੀ ਅੱਛਾ ਕੋਈ ਨਾ ਹਾਂ ਹਾਂ ਅੱਛਾ ਓਕੇ ਕੋਈ ਨਾ ਮੈਂ ਆਪਣੇ ਘਰਦਿਆਂ ਨਾਲ ਸਲਾਹ ਕਰਕੇ ਦੱਸੂਂਗੀ ਹੋਰ ਯਾਰ ਬਾਕੀ ਰਿਜਲਟ ਦੀ ਵੇਟ ਕਰਦੀ ਠੀਕ ਹੈ